ਮੈਂ ਪੰਜਾਬ ਦਾ ਹੀ ਰਹਿਣ ਵਾਲਾ ਹਾਂ ਅਤੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਮੇਰੇ ਘਰ ਵਿੱਚ ਸਾਰੇ ਪੰਜਾਬੀ ਹੀ ਬੋਲਦੇ ਹਨ ਮੈਂ ਵੀ ਬਚਪਨ ਤੋਂ ਹੀ ਪੰਜਾਬੀ ਬੋਲਦਾ ਹਾਂ ਅਤੇ ਘਰ ਵਿੱਚ ਸ ਸਭ ਦੇ ਬੋਲਣ ਕਰਕੇ ਹੀ ਮੈਨੂੰ ਪੰਜਾਬੀ ਬੋਲਣੀ ਆ ਗਈ ਸੀ ਅਤੇ ਪੜ੍ਹਨੀ ਅਤੇ ਲਿਖਣੀ ਮੈਂ ਸਕੂਲ ਵਿੱਚ ਸਿੱਖੀ ਹੈ ਪੰਜਾਬੀ ਹੀ ਸਾਡੀ ਮਾਂ ਬੋਲੀ ਹੈ ਅਤੇ ਮੈਨੂੰ ਬਾਕੀ ਭਾਸ਼ਾਵਾਂ ਵਿੱਚ ਬੋਲਣੀ ਹੀ ਜ਼ਿਆਦਾ ਪਸੰਦ ਹੈ ਅਤੇ ਪੰਜਾਬੀ ਬੋਲਦੇ ਸਮੇਂ ਬਹੁਤ ਸਕੂਨ ਹੀ ਮਿਲਦਾ ਹੈ ਪੰਜਾਬੀ ਹੈ ਵੀ ਬਹੁਤ ਮਿੱਠੀ ਭਾਸ਼ਾ ਹੈ